ਮੈਂ ਲਿਖਣ ਦੇ ਉੱਪਰ ਕੋਈ ਵੀ ਪ੍ਰੋਫੈਸ਼ਨਲ ਸਿੱਖਿਆ ਨਹੀਂ ਲਿਤੀ ਹੋਈ ਪਰ ਮੈਂ ਬਹੁਤ ਸਾਰੇ ਰਾਈਟਰਾਂ ਨੂੰ ਬਹੁਤ ਸਾਰੇ ਲੇਖਕਾਂ ਨੂੰ ਪੜ੍ਹਦਾ ਹਾਂ ਸੁਣਦਾ ਹਾਂ ਅ ਅਤੇ ਜੋ ਜੋ ਲਿਖਦੇ ਨੇ ਅ ਉਹਨਾਂ ਨੂੰ ਪੜ੍ਹਦਾ ਹਾਂ ਉਹਨਾਂ ਦੇ ਉੱਪਰ ਦੇਖਦਾ ਹਾਂ ਕਿ ਕਿਵੇਂ ਕੰਮ ਕੀਤਾ ਗਿਆ ਹੈ ਮੈਂ ਇਹਨਾਂ ਤੋਂ ਇਹਨਾਂ ਦੀ ਰਾਈਟਿੰਗ ਆ ਹੀ ਜਿਵੇਂ ਸ਼ਿਵ ਕੁਮਾਰ ਬਟਾਲਵੀ ਜੀ ਉਨਾਂ ਦੀਆਂ ਕੁਛ ਰਚਨਾਵਾਂ ਭੱਠੀ ਵਾਲੀਏ ਇਹ ਮੇਰਾ ਗੀਤ ਕਿਸੇ ਨਾ ਗਾਣਾ ਅਤੇ ਭਾਈ ਵੀਰ ਸਿੰਘ ਜੀ ਦੀ ਉਹ ਰਚਨਾ ਸਮੇਂ ਅਤੇ ਸੁਰਜੀਤ ਪਾਚਰ ਪਾਤਰ ਜੀ ਦੀਆਂ ਵੀ ਬਹੁਤ ਸਾਰੀਆਂ ਰਚਨਾਵਾਂ ਪੜ੍ਹੀਆਂ ਹਨ ਅਤੇ ਉਹਨਾਂ ਤੋਂ ਮੈਂ ਪੜ੍ਹ ਪੜ੍ਹ ਕੇ ਉਹਨਾਂ ਵਰਗਾ ਥੋੜ੍ਹਾ ਬਹੁਤ ਲਿਖਣ ਦੀ ਕੋਸ਼ਿਸ਼ ਕਰਦਾ ਹਾਂ ਅਤੇ ਪਰ ਮੈਂ ਉਹਨਾਂ ਵਰਗਾ ਇੰਨਾ ਲਿਖ ਨਹੀਂ ਪਾਉਂਦਾ ਕਿਉਂਕਿ ਉਹ ਬਹੁਤ ਹੀ ਵੱਡੇ ਨਾਮ ਨੇ ਬਹੁਤ ਹੀ ਦੇਰ ਤੋਂ ਲਿਖਦੇ ਪਏ ਨੇ ਅਤੇ ਪਰ ਇਹਨਾਂ ਨੂੰ ਹੀ ਪੜ੍ਹ ਪੜ੍ਹ ਕੇ ਮੈਂ ਤਕਨੀਕੀ ਪਹਿਲੂਆਂ ਅਤੇ ਵਿਆਕਰਣ ਦੀ ਬਣਤਰ ਦੇ ਰਚਨਾਤਮਕ ਪੱਖ ਨੂੰ ਸੰਤੁਲਿਤ ਕਰਨ ਲੱਗ ਪਿਆ ਹਾਂ ਇਹ ਇਹਨਾਂ ਨੂੰ ਪੜ੍ਹ ਪੜ੍ਹ ਕੇ ਹੀ ਮੈਂ ਸਿੱਖ ਰਿਹਾ ਹਾਂ ਅਤੇ ਹੌਲੀ ਹੌਲੀ ਥੋੜ੍ਹਾ ਥੋੜ੍ਹਾ ਕਰਕੇ ਲਿਖ ਰਿਹਾ ਹਾਂ ਮੈਂ ਉੱਦਾਂ ਗਾਉਂਦਾ ਵਹਾਂ ਅਤੇ ਮੈ ਮੈਨੂੰ ਫਿਰ ਹੁਣ ਜਿਵੇਂ ਸ਼ਿਵ ਕੁਮਾਰ ਬਟਾਲਵੀ ਜੀ ਨੂੰ ਮੈਂ ਪੜ੍ਹਦਾ ਹਾਂ ਅਤੇ ਫਿਰ ਮੈਂ ਉਹਨਾਂ ਦੇ ਵਾਂਗ ਹੀ ਗਾਣੇ ਅੱਗੇ ਦੀ ਅੱਗੇ ਲਿਖਣ ਦੀ ਕੋਸ਼ਿਸ਼ ਕਰਦਾ ਹਾਂ ਅਤੇ ਮੈਂ ਇਹਦੇ ਚ ਥੋੜ੍ਹਾ ਥੋੜ੍ਹਾ ਕਰਕੇ ਮਿਹਨਤ ਨਾਲ ਕਾਮਯਾਬ ਹੋ ਰਿਹਾ ਹਾਂ ਅਤੇ ਮੈਂ ਨਵੀਆਂ ਦੀ ਨਵੀਆਂ ਚੀਜ਼ਾਂ ਸਿੱਖ ਰਿਹਾ ਹਾਂ